ਮਾਰਸ਼ਲ ਆਰਟ ਲੜਾਈ ਦੀ ਤਕਨੀਕ ਹੀ ਨਹੀਂ ਬਲਕਿ ਇਹ ਸਰੀਰ ਨੂੰ ਬਿਹਤਰ ਬਣਾਉਣ ਦਾ ਇੱਕ ਤਰੀਕਾ ਵੀ ਹੈ ਮਾਰਸ਼ਲ ਆਰਟ ਸਾਡੇ ਸਰੀਰ ਅਤੇ ਮਾਨਸਿਕਤਾ ਦਾ ਇੱਕ ਆਪਸੀ ਯੋਗਦਾਨ ਹੈ ਜਾਂ ਆਪਸੀ ਸੰਯੁਕਤ ਸੰਚਾਲਨ ਕਰਦਾ ਹੈ ਜਿਸ ਕਰਕੇ ਸਾਨੂੰ ਸਰੀਰ ਅਤੇ ਦਿਮਾਗ ਦੇ ਤਾਲਮੇਲ ਨੂੰ ਸਮਝਣ ਦਾ ਇੱਕ ਜ਼ਰੀਆ ਮਿਲ ਜਾਂਦਾ ਹੈ ਮਾਰਸ਼ਲ ਆਰਟ ਸਾਨੂੰ ਆਤਮ ਵਿਸ਼ਵਾਸ ਆਪਣੇ ਡਰ ਉੱਤੇ ਕਾਬੂ ਕਰਨ ਦੇ ਉੱਤੇ ਵੀ ਹੈਲਪ ਕਰਦਾ ਹੈ ਮਾਰਸ਼ਲ ਆਰਟ ਵਿੱਚ ਜਦੋਂ ਇੱਕ ਵਿਅਕਤੀ ਪਹਿਲੀ ਬਾਰ ਸਟੇਜ ਉੱਤੇ ਜਾਂਦਾ ਹੈ ਜਾਂ ਸੈੱਟ ਉੱਤੇ ਜਾਂਦਾ ਹੈ ਤਾਂ ਉਹ ਆਪਣੇ ਅੰਦਰ ਡਰ ਮਹਿਸੂਸ ਕਰਦਾ ਹੈ ਪਰ ਰੋਜ਼ ਪ੍ਰੈਕਟਿਸ ਕਰਨ ਦੇ ਨਾਲ਼ ਹਾਰ ਜਿੱਤ ਨੂੰ ਸਮਝਦਾ ਹੋਇਆ ਅਤੇ ਆਪਣੇ ਦਿਲ ਨੂੰ ਉਹ ਮਜ਼ਬੂਤ ਬਣਾ ਲੈਂਦਾ ਹੈ ਤਾਂ ਹੌਲ਼ੀ ਹੌਲ਼ੀ ਉਹ ਆਪਣੇ ਡਰ ਉੱਤੇ ਕਾਬੂ ਵੀ ਪਾ ਲੈਂਦਾ ਹੈ ਇਸ ਤਰ੍ਹਾਂ ਉਹਦੇ ਅੰਦਰ ਆਤਮ ਵਿਸ਼ਵਾਸ਼ ਵੀ ਬਣਦਾ ਹੈ ਉਹ ਆਪਣੇ ਅੰਦਰ ਇੱਕ ਅਨੁਸ਼ਾਸਨ ਅਤੇ ਸਬਰ ਨੂੰ ਵੀ ਪੈਦਾ ਕਰਦਾ ਹੈ ਕਿਉਂਕਿ ਮਾਰਸ਼ਲ ਆਰਟ ਵਿੱਚ ਸਬਰ ਅਤੇ ਅਨੁਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਹਰ ਵੇਲ਼ੇ ਕਿਸੇ ਵੀ ਨਤੀਜੇ ਉੱਤੇ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਓਸ ਚੀਜ਼ ਦੀ ਅਸਲੀ ਅਹਿਮੀਅਤ ਨਹੀਂ ਦੇਖ ਪਾਉਂਦੇ ਸਹੀ ਮਨੋਵਿਰਤੀ ਉਹੀ ਹੈ ਜੋ ਇੱਕ ਵਿਅਕਤੀ ਨੂੰ ਹਰ ਦਿਨ ਬਿਹਤਰ ਬਣਨ ਲਈ ਮੋਟੀਵੇਟ ਕਰੇ ਨਾ ਕਿ ਤੁਰੰਤ ਨਤੀਜਿਆਂ ਦੀ ਉਮੀਦ ਰੱਖੇ ਅਨੁਸ਼ਾਸਨ ਦੇ ਨਾਲ਼ ਤੁਸੀਂ ਆਪਣੇ ਆਪ ਨੂੰ ਇੱਕ ਸਹੀ ਤਰੀਕੇ ਦੇ ਨਾਲ਼ ਢਾਲ ਲੈਂਦੇ ਹੋ ਅਤੇ ਤੁਸੀਂ ਆਪਣੀ ਅੰਦਰੂਨੀ ਸ਼ਕਤੀ ਅਤੇ ਮਾਨਸਿਕ ਸ਼ਕਤੀ ਨੂੰ ਵੀ ਇਸ ਤਰ੍ਹਾਂ ਵਧਾ ਲੈਂਦੇ ਹੋ ਤੁਸੀਂ ਆਪਣੇ ਆਪ 'ਤੇ ਕਾਬੂ ਕਰਨਾ ਸਿੱਖਦੇ ਹੋ ਤੁਸੀਂ ਆਪਣੇ ਦਿਮਾਗ ਅਤੇ ਸਰੀਰ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਮਾਰਸ਼ਲ ਆਰਟ ਇੱਕ ਸਰੀਰ ਨੂੰ ਫਿੱਟ ਰੱਖਣ ਦਾ ਵੀ ਬਹੁਤ ਵਧੀਆ ਤਰੀਕਾ ਹੈ ਮਾਰਸ਼ਲ ਆਰਟ ਦੇ ਨਾਲ਼ ਅਸੀਂ ਆਪਣੇ ਸਰੀਰ ਨੂੰ ਰੋਜ਼ ਕਸਰਤ ਕਰਕੇ ਮਜ਼ਬੂਤ ਵੀ ਬਣਾਉਂਦੇ ਹਾਂ ਅਤੇ ਕਈ ਬਿਮਾਰੀਆਂ ਤੋਂ ਬੱਚ ਵੀ ਜਾਂਦੇ ਹਾਂ ਇਸ ਤਰ੍ਹਾਂ ਮਾਰਸ਼ਲ ਆਰਟ ਜੀਵਨ ਵਿੱਚ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਇਹ ਸਾਨੂੰ ਰੋਜ਼ ਅੱਗੇ ਵਧਣ ਦੀ ਵਿਧੀ ਬਤਾਉਂਦਾ ਹੈ ਕਦੇ ਹਾਰ ਨਾ ਮੰਨਣ ਬਾਰੇ ਦੱਸਦਾ ਹੈ ਹਮੇਸ਼ਾ ਹਾਰ ਨੂੰ ਇੱਕ ਨਵੀ ਸਿੱਖ ਵਾਂਗੂ ਦਿਖਾਉਂਦਾ ਹੈ ਅਤੇ ਹਮੇਸ਼ਾ ਆਪਣੀ ਯਾਤਰਾ ਜਾਰੀ ਰੱਖਣ ਵਾਸਤੇ ਦੱਸਦਾ ਹੈ ਇਹ ਸਾਨੂੰ ਕਦੇ ਰੁਕਣ ਵਾਸਤੇ ਨਹੀਂ ਦੱਸਦਾ ਇਹ ਸਾਨੂੰ ਹਮੇਸ਼ਾ ਸਮਝਣਾ ਸਿੱਖਣਾ ਅਤੇ ਅੱਗੇ ਵਧਣ ਨੂੰ ਪ੍ਰੇਰਿਤ ਕਰਦਾ ਹੈ